ਮੈਂ ਇਸ ਸਾਲ ਹੀ ਆਪਣੇ ਕੋਲਿਜ ਨੂੰ ਰੀਪ੍ਰਜੈਂਟ ਕਰਨ ਲਈ ਯੂਥ ਫੈਸਟ ਦੇ ਵਿੱਚ ਹਿੱਸਾ ਲਿਆ ਸੀ ਅਤੇ ਮੈਂ ਪਿਛਲੇ ਦੋ ਸਾਲਾਂ ਦੇ ਵਿੱਚ ਵੀ ਲਗਾਤਾਰ ਯੂਥ ਫੈਸਟ ਦੇ ਵਿੱਚ ਹਿੱਸਾ ਲੈਂਦੀ ਆਈ ਹਾਂ ਮੈਂ ਹਰ ਸਾਲ ਫਾਈਨ ਆਰਟਸ ਦੀ ਇੱਕ ਆਈਟਮ ਸਟਿੱਲ ਲਾਈਫ ਪੇਂਟਿੰਗ ਦੇ ਵਿੱਚ ਹਿੱਸਾ ਲੈਂਦੀ ਹਾਂ ਪਹਿਲੇ ਸਾਲ ਮੇਰਾ ਉਸ ਵਿੱਚ ਪ੍ਰਾਈਜ਼ ਵੀ ਆਇਆ ਸੀ ਜਿਸ ਨਾਲ ਮੈਂ ਬਹੁਤ ਖੁਸ਼ ਸੀ ਪਰ ਪਿਛਲੇ ਸਾਲ ਮੇਰਾ ਉਸ ਵਿੱਚ ਪ੍ਰਾਈਜ਼ ਨਾ ਆਣ ਕਰਕੇ ਮੈਂ ਕੁਛ ਨਿਰਾਸ਼ ਸੀ ਅਤੇ ਮੈਂ ਚਾਹੁੰਦੀ ਸੀ ਕਿ ਇਸ ਸਾਲ ਮੈਂ ਫਾਈਨ ਆਰਟਸ ਦੀ ਕਿਸੇ ਹੋਰ ਆਈਟਮ ਵਿੱਚ ਭਾਗ ਲਵਾਂ ਜਿਸ ਨਾਲ ਮੇਰਾ ਪ੍ਰਾਈਜ਼ ਆਉਣ ਦਾ ਚਾਂਸ ਵਧੇ ਅਤੇ ਮੈਂ ਸਟਿੱਲ ਲਾਈਫ ਨੂੰ ਛੱਡ ਕੇ ਕੌਲਾਜ਼ ਮੇਕਿੰਗ ਦੇ ਵਿੱਚ ਪਾਟੀਸਪੇਟ ਕੀਤਾ ਇੱਕ ਤਰ੍ਹਾਂ ਨਾਲ ਮੈਂ ਇਹ ਰਿਸਕ ਲਿਆ ਸੀ ਕਿਉਂਕਿ ਕੌਲਾਜ ਮੇਕਿੰਗ ਮੈਂ ਅੱਜ ਤੱਕ ਕਦੇ ਨਹੀਂ ਸੀ ਕੀਤੀ ਮੈਨੂੰ ਸਿਰਫ਼ ਇਹ ਦੇ ਬਾਰੇ ਥੋੜ੍ਹਾ ਬਹੁਤ ਪਤਾ ਸੀ ਬਟ ਮੈਂ ਆਪਣੇ ਹੱਥਾਂ ਨਾਲ ਕਦੀ ਕੋਈ ਕੌਲਾਜ਼ ਨਹੀਂ ਸੀ ਬਣਾਇਆ ਅਤੇ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਮੈਂ ਆਪਣੇ ਨਾਲ ਦੇ ਫ੍ਰੈਂਡਸ ਤੋਂ ਅਤੇ ਟੀਚਰਸ ਤੋਂ ਗਾਈਡੈਂਸ ਲੈ ਕੇ ਕੌਲਾਜ ਮੇਕਿੰਗ ਦੇ ਬਾਰੇ ਜਾਣਿਆ ਉਹ ਦੀ ਪ੍ਰੈਕਟਿਸ ਕੀਤੀ ਅਤੇ ਯੂਥ ਫੈਸਟ ਵਾਲੇ ਦਿਨ ਮੇਰਾ ਪ੍ਰਾਈਜ਼ ਤਾਂ ਨਹੀਂ ਆਇਆ ਬਟ ਉੱਥੇ ਜਾ ਕੇ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ ਅਤੇ ਜਿਨ੍ਹਾਂ ਦਾ ਪ੍ਰਾਈਜ਼ ਆਇਆ ਉਨ੍ਹਾਂ ਦੇ ਬਣਾਏ ਹੋਏ ਕੌਲਾਜ ਦੇਖੇ ਮੈਂ ਉਹਨਾਂ ਦੇ ਕੌਲਾਜ ਅਤੇ ਆਪਣੇ ਕੌਲਾਜ ਨੂੰ ਇਕੱਠਾ ਰੱਖ ਕੇ ਉਹਨਾਂ ਵਿੱਚ ਗਲਤੀਆਂ ਦੇਖੀਆਂ ਕਿ ਕੀ ਸੀ ਅਤੇ ਇਸ ਨਾਲ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ ਅਤੇ ਮੈਂ ਇਹ ਰਿਸਕ ਲੈਣ ਨਾਲ ਬੁਹਤ ਖੁਸ਼ ਹਾਂ ਕਿਉਂਕਿ ਮੈਂ ਇੱਕ ਨਵਾਂ ਨਵਾਂ ਫੌਮ ਔਫ ਆਰਟ ਸਿੱਖ ਲਿਆ ਅਤੇ ਮੈਂ ਲੋਕਾਂ ਨੂੰ ਵੀ ਇਹ ਹੀ ਸਲਾਹ ਦੇਣਾ ਚਾਹਵਾਂਗੀ ਕਿ ਸਾਨੂੰ ਰਿਸਕ ਲੈਣੇ ਚਾਹੀਦੇ ਨੇ ਕਿਉਂਕਿ ਇਨਸਾਨ ਜੋ ਹੈ ਉਹ ਕਦੇ ਵੀ ਹਾਰਦਾ ਨਹੀਂ ਹੈ ਉਹ ਜਾਂ ਤਾਂ ਜਿੱਤ ਜਾਂਦਾ ਹੈ ਜਾਂ ਕੁਛ ਸਿੱਖਦਾ ਹੈ ਅਤੇ ਮੈਂ ਵੀ ਇਸੇ ਤਰ੍ਹਾਂ ਇੱਕ ਰਿਸਕ ਲੈ ਕੇ ਇੱਕ ਨਵਾਂ ਜੋ ਹੈ ਉਹ ਆਰਟ ਫੌਮ ਸਿੱਖਿਆ